ਸ਼ੋਸ਼ਲ ਮੀਡੀਆ ਨੇ ਦੀ ਵਰਤੋਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਕਾਫ਼ੀ ਬਦਲਾਅ ਆਇਆ ਜਿੱਥੇ ਪਹਿਲਾਂ ਲੋਕ ਚਿੱਠੀਆਂ ਰਾਹੀਂ ਗੱਲਬਾਤ ਕਰਦੇ ਸੀ ਇੱਕ ਦੂਜੇ ਦੇ ਘਰ ਜਾ ਕੇ ਗੱਲਬਾਤ ਕਰਦੇ ਸੀ ਉੱਥੇ ਅੱਜ ਇੰਟਰਨੈਟ ਦੀ ਵਰਤੋਂ ਦੇ ਨਾਲ ਇੱਕ ਦੂਜੇ ਨੂੰ ਉੱਥੇ ਵੀਡੀਓ ਕਾਲਿੰਗ ਦੇ ਨਾਲ ਹੀ ਗੱਲਬਾਤ ਕਰ ਲੈਂਦੇ ਮੋਬਾਇਲ ਨੇ ਮੋਬਾਇਲ ਦੇ ਨਾਲ ਅਸੀਂ ਸਿਰਫ਼ ਗੱਲਬਾਤ ਹੀ ਕਰ ਸਕਦੇ ਹਾਂ ਵੀਡੀਓ ਕਾਲਿੰਗ ਦੇ ਨਾਲ ਅਸੀਂ ਭਾਵੇਂ ਸੱਤ ਸਮੁੰਦਰ ਪਾਰ ਹੋਵੇ ਉਸ ਦੇ ਨਾਲ ਵੀ ਆਹਮਣੇ ਸਾਹਮਣੇ ਬੈਠ ਕੇ ਤਾਂ ਗੱਲਬਾਤ ਕਰ ਸਕਦੇ ਹਾਂ ਇੱਥੋਂ ਨਾ ਪੂਰਾ ਸੰਸਾਰ ਹੀ ਇੱਕ ਮੁੱਠੀ ਦੇ ਵਿੱਚ ਮਤਲਬ ਜਿਸ ਤਰ੍ਹਾਂ ਸੋਸ਼ਲ ਮੀਡੀਆ ਨੇ ਲੈ ਲਿਆ ਹੋਵੇ ਇਸ ਦੇ ਨਕਾਰਮਤ ਨਕਾਰਆਤਮਕ ਨਤੀਜੇ ਇਹ ਹਨ ਕਿ ਅੱਜ ਬੱਚਾ ਹੋਵੇ ਜਾਂ ਬੁੱਢਾ ਜਵਾਨ ਹੋਵੇ ਜਾਂ ਅਧੇੜ ਸਭ ਮਤਲਬ ਇਹਦੀ ਫੋਨ ਦੀ ਇੰਨੀ ਕੁ ਵਰਤੋਂ ਕਰਨ ਲੱਗ ਪਏ ਹੈ ਤਕਰੀਬਨ ਮਤਲਬ ਇੱਕ ਚੌਵੀ ਘੰਟੇ ਦੇ ਵਿੱਚ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਤੱਕ ਵੀ ਈਵਨ ਮਤਲਬ ਇਹ ਬੱਚੇ ਜਿਹੜੇ ਆ ਇਹਨੂੰ ਬਤਾ ਬਿਤਾ ਲੈਂਦੇ ਆ ਇਹਦੇ 'ਤੇ ਟਾਈਮ ਜੋ ਸਾਡੀ ਸਿਹਤ ਵਾਸਤੇ ਸਾਡੀਆਂ ਅੱਖਾਂ ਵਾਸਤੇ ਬਹੁਤ ਨੁਕਸਾਨਦੇਹ ਆ ਇਸ ਦਾ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਧੰਨਵਾਦ